ਤਰਾਕੀ ਮੇਰੀ ਮਨ ਪਸੰਦ ਹੋਬੀ ਹੈ ਮੈਂ ਬਚਪਨ ਵਿੱਚ ਏ ਗਰਮੀਆਂ ਵਿੱਚ ਕਈ ਕਈ ਦਿਨਾਂ ਤੱਕ ਰੋਜ਼ ਰੋਜ਼ ਇਹ ਕਾਫੀ ਟਾਈਮ ਤੱਕ ਤੈਰਾਕੀ ਕਰਦਾ ਸੀ ਸਾਡੇ ਘਰ ਦੇ ਇਹ ਸੌ ਮੀਟਰ ਦੇ ਕੋਲ ਹੀ ਇੱਕ ਸੂਆ ਹੈ ਜਿਸ ਵਿੱਚ ਆਪਾਂ ਰੋਜ਼ਾਨਾ ਬਚਪਨ ਵਿੱਚ ਆਪਣੇ ਦੋਸਤਾਂ ਨਾਲ ਤੈਰਾਕੀ ਕਰਨ ਜਾਂਦੇ ਸੀ ਜਿਸ ਕਰਕੇ ਮੈਨੂੰ ਤਰਾਕੀ ਵਿੱਚ ਕਾਫੀ ਐਕਸਪੀਰੀਅਂਸ ਹੋ ਗਿਆ ਅਤੇ ਇੱਕ ਵਾਰ ਇਹ ਇੱਕ ਮਹੀਨੇ ਪਹਿਲਾਂ ਦੀ ਗੱਲ ਹੈ ਇੱਕ ਵਾਰ ਛੋਟਾ ਜਿਹਾ ਬੱਚਾ ਦਸ ਬਾਰ੍ਹਾਂ ਸਾਲ ਦਾ ਪੁਲ ਉਥੋਂ ਜਾ ਰਿਹਾ ਸੀ ਉਸਦਾ ਪੈਰ ਫਿਸਲਨ ਕਰਕੇ ਉਹ ਨਹਿਰ ਵਿੱਚ ਸੂਏ ਵਿੱਚ ਗਿਰ ਗਿਆ ਅਤੇ ਮੈਨੂੰ ਉਸਦੀ ਜਦੋਂ ਚੀਕਣ ਦੀ ਆਵਾਜ਼ ਆਈ ਤਾਂ ਮੈਂ ਜਲਦ ਹੀ ਸੂਏ ਵਿੱਚ ਛਲਾਂਗ ਮਾਰੀ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੈਂ ਉਸਨੂੰ ਉਸਨੂੰ ਫੜ ਕੇ ਕਿਨਾਰੇ ਲਿਆਂਦਾ ਅਤੇ ਬਾਅਦ ਵਿੱਚ ਉਸਨੂੰ ਇਹ ਰਸਤੇ ਵਿੱਚ ਏ ਲਿਜਾ ਕੇ ਉਸ ਦੇ ਮਦਦ ਕੀਤੀ ਉਸ ਦੇ ਮੂੰਹ 'ਚੋਂ ਪਾਣੀ ਕੱਢਿਆ ਅਤੇ ਉਸਦੀ ਜਾਨ ਬਚਾਈ